ਪੰਜਾਬ ਵਿੱਚ ਬਾਹਰ ਜਾਣ ਲਈ ਅਤੇ ਮਸਤੀ ਕਰਨ ਲਈ ਬਹੁਤ ਹੀ ਥਾਵਾਂ ਹਨ ਜਿਵੇਂ ਕਿ ਰਣਜੀਤ ਸਾਗਰ ਡੈਮ ਬਸੋਲੀ ਪੁੱਲ ਹਰਿਮੰਦਰ ਸਾਹਿਬ ਹੋਰ ਵੀ ਬਹੁਤ ਥਾਵਾਂ ਹਨ ਉਹਨਾਂ ਵਿੱਚੋਂ ਮੈਂ ਤੁਹਾਨੂੰ ਇੱਕ ਮਸ਼ਹੂਰ ਜਗ੍ਹਾ ਬਾਰੇ ਦੱਸਣਾ ਚਾਹੁੰਦਾ ਹਾਂ ਜਿਸਦਾ ਨਾਮ ਹੈ ਸਾਡਾ ਪਿੰਡ ਜੋ ਕਿ ਅੰਮ੍ਰਿਤਸਰ ਵਿੱਚ ਸਥਿਤ ਹੈ ਸਾਡਾ ਪਿੰਡ ਵਿੱਚ ਸਾਨੂੰ ਆਪਣੇ ਪੰਜਾਬ ਦੇ ਕਲਚਰ ਸੱਭਿਆਚਾਰ ਬਾਰੇ ਦੱਸਿਆ ਜਾਂਦਾ ਹੈ ਕਿ ਉੱਥੇ ਇਹ ਦੱਸਿਆ ਜਾਂਦਾ ਹੈ ਕਿ ਪੁਰਾਣੇ ਜ਼ਮਾਨੇ ਵਿੱਚ ਲੋਕ ਕਿਵੇਂ ਰਹਿੰਦੇ ਸਹਿੰਦੇ ਸਨ ਕਿਹੜੀ ਕਿਹੜੀ ਚੀਜ਼ਾਂ ਦੀ ਵਰਤੋਂ ਕਰਦੇ ਸਨ ਅਤੇ ਪੰਜਾਬ ਦੀ ਪ੍ਰਸਿੱਧ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ ਹੈ ਜੀ ਉੱਥੇ ਇੱਕ ਹੀਰ ਰਾਂਝੇ ਦੀ ਕਹਾਣੀ ਬਾਰੇ ਦੱਸਿਆ ਜਾਂਦਾ ਹੈ ਸਿਖਾਇਆ ਜਾਂਦਾ ਹੈ ਪੁਰਾਣੇ ਜ਼ਮਾਨੇ ਦੀਆਂ ਲੜਾਈਆਂ ਜੰਗਾਂ ਬਾਰੇ ਸੋ ਪੰਜਾਬ ਵਿੱਚ ਬਹੁਤ ਚੀਜ਼ਾਂ ਘੁੰਮਣ ਫਿਰਨ ਨੂੰ ਹੈ ਸੋ ਘੁੰਮੋ ਫਿਰੋ ਐਸ਼ ਕਰੋ ਇੰਜੋਏ ਕਰੋ ਧੰਨਵਾਦ